ਪਾਣੀ ਨੂੰ ਫਿਲਟਰ ਅਤੇ ਸ਼ੁੱਧ ਕਰਨ ਲਈ ਅਸੀਂ ਬਹੁਤ ਸਾਰੇ ਅਭਿਆਸਾਂ ਦੀ ਪਾਲਣਾ ਕਰਦੇ ਹਾਂ ਜਿਨ੍ਹਾਂ ਵਿੱਚ ਅੱਜ ਦੇ ਜਮਾਨੇ ਵਿੱਚ ਸਭ ਤੋਂ ਉੱਪਰ ਵੋਟਰ ਪਿਓਰੀਫਾਇਰ ਆਰੋ ਐਕੋਆ ਗਾਰਡ ਨੇ ਠੀਕ ਹੈ ਜੋ ਵੀ ਜਿਨ੍ਹਾਂ ਦੇ ਘਰਾਂ 'ਚ ਵੀ ਨੇ ਉਹਦੇ ਨਾਲ ਕਾਫੀ ਉਹਨਾਂ ਨੂੰ ਫਾਇਦਾ ਹੋ ਰਿਹਾ ਹੈ ਠੀਕ ਹੈ ਜਿਨ੍ਹਾਂ ਦੇ ਕੋਲ ਐ ਸੁਵਿਧਾ ਉਪਲਬਧ ਨਹੀਂ ਹੈਗੀ ਉਹ ਲੋਕ ਪਾਣੀ ਨੂੰ ਫਿਲਟਰ ਕਰਨ ਲਈ ਉਹਨੂੰ ਉਬਾਲ ਕੇ ਠੰਡਾ ਕਰਕੇ ਇਸਤੇਮਾਲ ਕਰ ਸਕਦੇ ਹਨ ਕੁਛ ਲੋਕ ਇਹਨਾਂ ਦੇ ਵਿੱਚ ਫਟਕਰੀ ਪਾ ਕੇ ਇਹਨਾਂ ਦਾ ਇਸਤੇਮਾਲ ਕਰ ਸਕਦੇ ਹਨ ਉਹ ਵੀ ਇੱਕ ਫਿਲਟਰ ਅਤੇ ਸ਼ੁੱਧ ਪਾਣੀ ਦੀ ਤਰ੍ਹਾਂ ਹੀ ਹੋ ਜਾਂਦਾ ਕਿਉਂਕਿ ਪਾਣੀ ਨੂੰ ਫਿਲਟਰ ਕਰਨਾ ਅੱਜ ਦੇ ਜਮਾਨੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਪਾਣੀ ਦੇ ਵਿੱਚ ਇੰਨੀਆਂ ਕੁ ਬਿਮਾਰੀਆਂ ਹੈਗੀਆਂ ਇੰਨੀਆਂ ਕੁ ਬਿਮਾਰੀਆਂ ਨੇ ਕਿ ਤੁਹਾਡੇ ਲਈ ਬਹੁਤ ਔਖਾ ਹੈ ਉਹਨਾਂ ਬਿਮਾਰੀਆਂ ਨੂੰ ਕੱਲ੍ਹ ਨੂੰ ਸੇੜਨਾ ਇਸ ਕਰਕੇ ਇਹਨੂੰ ਫਿਲਟਰ ਕਰਨਾ ਅਤੇ ਸ਼ੁੱਧ ਕਰਨਾ ਬਹੁਤ ਜ਼ਰੂਰੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਜਿਹੜੀਆਂ ਨੇ ਨਾ ਉਹ ਤੁਹਾਨੂੰ ਬਹੁਤ ਪਰੇਸ਼ਾਨ ਕਰਦੀਆਂ ਨੇ ਆਉਣ ਵਾਲੇ ਸਮੇਂ 'ਚ ਇਸ ਕਰਕੇ ਪਾਣੀ ਨੂੰ ਫਿਲਟਰ ਅਤੇ ਸ਼ੁੱਧ ਕਰਕੇ ਇਸਤੇਮਾਲ ਕਰੋ ਤਾਂ ਕਿ ਆਉਣ ਵਾਲੇ ਸਮੇਂ 'ਚ ਤੁਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਸਕੋ